ਹੈਲੋ ਭਾਅ ਜੀ ਤੁਸੀਂ ਫ਼ੂਡ ਵਲੋਗਰ ਬੋਲਦੇ ਭਾਅ ਜੀ ਕੀ ਹਾਲ ਚਾਲ ਵਧੀਆ ਭਾਅ ਜੀ ਵਧੀਆ ਭਾਅ ਜੀ ਮੈਂ ਅਭਿਸ਼ੇਕ ਬੋਲਦਾ ਤੁਹਾਡਾ ਨਾਮ ਭਾਅ ਜੀ ਮੈਂ ਹੁਸ਼ਿਆਰਪੁਰ ਆਇਆ ਅਤੇ ਮੈਂ ਕੁਛ ਖਾਣ ਨੂੰ ਸੋਚਦਾ ਪਿਆ ਵਧੀਆ ਨੂਡਲਸ ਕਿੱਥੋਂ ਮਿਲੂਗੇ ਜਿੱਦਾਂ ਕਿ ਭਾਅ ਜੀ ਰੇਹੜੀ ਦੇ ਦੱਸ ਦਿਓ ਭਾਅ ਜੀ ਹੋਰ ਅਤੇ ਭਾਅ ਜੀ ਮਨਚੂਰੀਅਨ ਇਹ ਕਿੱਧਰ ਹੈ ਭਾਅ ਜੀ ਐਡਰੈੱਸ ਦੱਸ ਦਿਓ ਮਾੜਾ ਹਾਂਜੀ ਹਾਂਜੀ ਠੀਕ ਹੈ ਭਾਜੀ ਅਤੇ ਭਾਅ ਜੀ ਸੈਂਡਵਿਚ ਵਗੈਰਾ ਕਿੱਥੋਂ ਮਿਲੂਗੇ ਵਧੀਆ ਅੱਛਾ ਇਹ ਕਿੱਥੇ ਪਵੇਗਾ ਭਾਅ ਜੀ ਅਤੇ ਭਾਅ ਜੀ ਵਧੀਆ ਚਾਂਪ ਕਿੱਥੋਂ ਮਿਲੂਗੀ ਇਹ ਕਿੱਥੇ ਹੈ ਭਾਅ ਜੀ ਅੱਛਾ ਅੱਛਾ ਠੀਕ ਹੈ ਭਾਅ ਜੀ ਅਤੇ ਜੇ ਮੈਂ ਭਾਅ ਜੀ ਪੈਟੀ ਵਗੈਰਾ ਖਾਣੀ ਹੋਈ ਕੋਈ ਵੈਸੇ ਨਾ ਭਾਅ ਜੀ ਫਰੈਂਚ ਦੀ ਵੀ ਸਵਾਦ ਹੁੰਦੀ ਆ ਅੱਛਾ ਭਾਅ ਜੀ ਸਰਤਾਜ ਕਿੱਥੇ ਆ ਅੱਛਾ ਅੱਛਾ ਹੋਰ ਭਾਅ ਜੀ ਹੋਰ ਕੀ ਬ੍ਰੇਕਫਾਸਟ ਕੀ ਇੱਥੇ ਫੇਮਸ ਆ ਹੁਸ਼ਿਆਰਪੁਰ 'ਚ ਪੂਰੀਆਂ ਕਿੱਥੋਂ ਦੀਆਂ ਅਤੇ ਦੇਸੀ ਘਿਓ ਵਾਲੀ ਪੂਰੀ ਕਿੱਥੇ ਮਿਲਦੀ ਭਾਅ ਜੀ ਅੱਛਾ ਠੀਕ ਹੈ ਭਾਅ ਜੀ ਸਵੇਰੇ ਕਿੰਨੇ ਕੁ ਵਜੇ ਤੱਕ ਮਿਲਦੀ ਆ ਉਰੇ ਨਾਨ ਵਗੈਰਾ ਕਿੱਥੇ ਮਿਲਦੇ ਆ ਹਾਂਜੀ ਹਾਂਜੀ ਹਾਂਜੀ ਅੱਛਾ ਅੱਛਾ ਜੱਗੂ ਕਿੱਥੇ ਆ ਭਾਅ ਜੀ ਠੀਕ ਹੈ ਠੀਕ ਹੈ ਅਤੇ ਚਿਕਨ ਚਿਕਨ ਵਧੀਆ ਕਿੱਥੋਂ ਮਿਲੂਗਾ ਅੱਛਾ ਓ ਅਤੇ ਡੋਸਾ ਕਿੱਥੋਂ ਮਿਲਜੂਗਾ ਵਧੀਆ ਮੈਂ ਸੁਣਿਆ ਕੇਫਿਟੇਰੀਆ ਦਾ ਵੀ ਵਧੀਆ ਹੁੰਦਾ ਜੇ ਭਾਅ ਜੀ ਰੇਹੜੀਆਂ ਤੋਂ ਕੁਛ ਵਧੀਆ ਖਾਣਾ ਹੋਵੇ ਫਿਰ ਅੱਛਾ ਅੱਛਾ ਭਾਅ ਜੀ ਅਤੇ ਫਲੂਦਾ ਵਗੈਰਾ ਜੇ ਪੀਣਾ ਹੋਵੇ ਚਲੋ ਠੀਕ ਹੈ ਭਾਅ ਜੀ ਫਿਰ ਮੈਂ ਟ੍ਰਾਇ ਕਰੂੰਗਾ ਓਕੇ